ਖਾਣਾ ਬਣਾਉਣਾ ਹਰ ਇੱਕ ਔਰਤ ਦਾ ਸ਼ੌਂਕ ਹੁੰਦਾ ਹੈ ਖਾਣੇ ਨੂੰ ਬਹੁਤ ਹੀ ਸਵਾਦਿਸ਼ਟ ਬਣਾਉਣ ਲਈ ਉਸ ਵਿੱਚ ਜੜੀ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਜੜੀ ਬੂਟੀਆਂ ਜਿਵੇਂ ਕਿ ਖੜ੍ਹੇ ਮਸਾਲੇ ਹਲਦੀ ਮਿਰਚ ਨਮਕ ਧਨੀਆ ਪੁਦੀਨਾ ਬਹੁਤ ਸਾਰੀਆਂ ਚੀ ਜੜੀ ਬੂਟੀਆਂ ਦਾ ਉਪਯੋਗ ਕਰਕੇ ਅਸੀਂ ਖਾਣੇ ਨੂੰ ਸਵਾਦਿਸ਼ਟ ਬਣਾ ਸਕਦੇ ਹਾਂ ਖਾਣੇ ਵਿੱਚ ਕਾਲੀ ਮਿਰਚ ਦੀ ਵਰਤੋਂ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਬਹੁਤ ਸਾਰੀਆਂ ਅਜਿਹੀਆਂ ਚੀਜੀਆਂ ਚੀਜ਼ਾਂ ਹਨ ਜਿਹਨਾਂ ਨੂੰ ਜੜੀ ਬੂਟੀਆਂ ਹਨ ਜਿਹਨਾਂ ਨੂੰ ਅਸੀਂ ਘਰ ਵਿੱਚ ਵੀ ਵੀ ਉਗਾ ਸਕਦੇ ਹਨ ਜਿਵੇਂ ਕਿ ਧਨੀਆ ਪੁਦੀਨਾ ਹਰੀ ਮਰਚ ਹੈ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਆਪਦੇ ਘਰ ਵਿੱਚ ਉਗਾ ਸਕਦੇ ਹਾਂ ਅਤੇ ਇਸ ਦੀ ਵਰਤੋਂ ਅਸੀਂ ਤਾਜ਼ਾ ਤਾਜ਼ਾ ਵਰਤੋਂ ਇਸਦੀ ਖਾਣੇ ਵਿੱਚ ਕਰ ਸਕਦੇ ਹਨ ਖਾਣਾ ਜੋ ਹੈ ਇਹਨਾਂ ਜੜੀਆਂ ਬੂਟੀਆਂ ਨਾਲ ਬਹੁਤ ਹੀ ਸਵਾਦਿਸ਼ਟ ਹੋ ਜਾਂਦਾ ਹੈ ਇਸ ਲਈ ਸਾਨੂੰ ਆਪਦੇ ਖਾਣੇ ਵਿੱਚ ਜੜੀ ਬੂਟੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਸਾਨੂੰ ਹਰ ਮਸਾਲੇ ਦਾ ਇੱਕ ਸਹੀ ਸਹੀ ਮਾਤਰਾ ਵਿੱਚ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਖਾਣਾ ਬਹੁਤ ਹੀ ਸਵਾਦਿਸ਼ਟ ਬਣ ਸਕੇ ਅਤੇ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ ਕਿਉਂਕਿ ਖਾਣਾ ਜੋ ਹੈ ਉਹ ਜੜੀ ਬੂਟੀਆਂ ਅਤੇ ਅਤੇ ਬਹੁਤ ਸਾਰੇ ਮਿਰਚ ਮਸਾਲਿਆਂ ਨਾਲ ਹੀ ਸਵਾਦਿਸ਼ਟ ਬਣਦਾ ਹੈ